ਹਾਂਜੀ ਮੈਮ ਮੈਂ ਡੋਕਟਰ ਹਰਮਨ ਬੋਲ ਰਿਹਾ ਜੀ ਤੁਸੀਂ ਹਾਂਜੀ ਹਾਂਜੀ ਹਰਗੁਣ ਦਾ ਫਾਦਰ ਬੋਲ ਰਿਹਾ ਜੀ ਕਿੱਥੋਂ ਬੋਲਦੇ ਜੇ ਤੁਸੀਂ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਓਕੇ ਹਾਂਜੀ ਹਾਂ ਮੈਮ ਸੋਰੀ ਐਕਚੁਲੀ ਮੈਂ ਪਹਿਲਾਂ ਵੀ ਨਾ ਤੁਹਾਡੇ ਪ੍ਰਿੰਸੀਪਲ ਮੈਡਮ ਨੂੰ ਕਿਹਾ ਸੀ ਕਿ ਜਿਹੜੇ ਪੀ ਟੀ ਮੀਟ ਦਾ ਟਾਈਮ ਥੋੜ੍ਹਾ ਅਰਲੀ ਰੱਖਿਆ ਕਰੋ ਕਿਉਂਕਿ ਅਸੀਂ ਦੋਵੇਂ ਹੀ ਪੇਰੈਂਟਸ ਟੀ ਟੀ ਜੋਬ ਕਰਦੇ ਹਾਂ ਅਤੇ ਕਿਉਂਕਿ ਸਵੇਰੇ ਸਵੇਰੇ ਅਸੀਂ ਡਿਊਟੀ 'ਤੇ ਚਲੇ ਜਾਈਦਾ ਅਤੇ ਮਿਲ ਨਹੀਂ ਸਕਦੇ ਦਸ ਵਜੇ ਦਾ ਟਾਈਮ ਰੱਖਿਆ ਸੀ ਜੇਕਰ ਤੁਸੀਂ ਅੱਠ ਵਜੇ ਦਾ ਰੱਖਦੇ ਤਾਂ ਸ਼ਾਇਦ ਅਸੀਂ ਮਿਲ ਲੈਂਦੇ ਜੀ ਹਾਂਜੀ ਦੱਸੋ ਠੀਕ ਹੈ ਠੀਕ ਹੈ ਜੀ ਹਾਂਜੀ ਓਕੇ ਓਕੇ ਓਕੇ ਮੈਮ ਪਤਾ ਨਹੀਂ ਕੀ ਪ੍ਰੋਬਲਮ ਆ ਕਿ ਹਰ ਵਾਰੀ ਮੈਥ ਦੇ ਪੇਪਰ ਤੋਂ ਪਹਿਲਾਂ ਉਹਨੂੰ ਬੁਖਾਰ ਹੋ ਜਾਂਦਾ ਅਤੇ ਉਹ ਇਸ ਵਾਰ ਵੀ ਜਾਂ ਤਾਂ ਉਹਦੀ ਤਿਆਰੀ ਨਹੀਂ ਸੀ ਜਾਂ ਕੁਛ ਇਸ ਤਰੀਕੇ ਦਾ ਸੀ ਕਿਉਂਕਿ ਅਸੀਂ ਨਾ ਐਕਚੁਲੀ ਮੈਡਮ ਨੂੰ ਵੀ ਕਿਹਾ ਸੀ ਕਿ ਥੋੜ੍ਹਾ ਜਿਹਾ ਇਹਦਾ ਖ਼ਾਸ ਖਿਆਲ ਕਰੋ ਸ਼ੁਰੂ ਤੋਂ ਹੀ ਕਿਸ ਮੈਥਮੈਟਿਕਸ 'ਚ ਇਹ ਥੋੜ੍ਹਾ ਜਿਹਾ ਵੀਕ ਹੋ ਜਾਂਦਾ ਅਤੇ ਅਸੀਂ ਕਿਹਾ ਸੀ ਕਿ ਕਲਾਸ ਟੈਸਟ ਲੈ ਕੇ ਰਿਵੀਜ਼ਨ ਕਰਵਾਓ ਅਤੇ ਅਤੇ ਮੈਮ ਦੇਖੋ ਮੈਮ ਦੇਖੋ ਨਾ ਕਿ ਬਾਕੀ ਸਬਜੈਕਟਸ ਵਿੱਚ ਦੇਖੋ ਹਾਂ ਠੀਕ ਹੈ ਮੈਮ ਠੀਕ ਹੈ ਠੀਕ ਹੈ ਤੁਸੀਂ ਚਲੋ ਕਨਸਰਨ ਦਿਖਾਇਆ ਮੈਂ ਐਕਚੁਲੀ ਮੈਂ ਵੀ ਮਿਲਣਾ ਚਾਹੁੰਦਾ ਸੀ ਪ੍ਰਿੰਸੀਪਲ ਮੈਮ ਨੂੰ ਕਿਉਂਕਿ ਜੇ ਬਾਕੀ ਸਬਜੈਕਟ ਵਿੱਚ ਠੀਕ ਚੱਲ ਰਿਹਾ ਤਾਂ ਮੈਥਮੈਟਿਕਸ ਦੇ ਵਿੱਚ ਹੀ ਕਿਉਂ ਵੀਕ ਚੱਲ ਰਿਹਾ ਅਤੇ ਮੈਂ ਕੋਸ਼ਿਸ਼ ਕਰਦਾ ਮੈਮ ਕਿ ਅੱਜ ਸ਼ਾਮ ਨੂੰ ਦੁਪਹਿਰ ਵੇਲੇ ਛੁੱਟੀ ਤੋਂ ਬਾਅਦ ਜਾਂ ਫਿਰ ਕੱਲ੍ਹ ਅਰਲੀ ਮੌਰਨਿੰਗ ਜੇ ਠੀਕ ਰਹੇਗਾ ਕਿਉਂਕਿ ਸਕੂਲ ਜਦੋਂ ਤੁਹਾਡਾ ਲੱਗਦਾ ਨੌ ਵਜੇ ਤੋਂ ਪਹਿਲਾਂ ਪਹਿਲਾਂ ਆ ਜਾਵਾਂ ਜੀ ਠੀਕ ਹੈ ਮੈਮ ਠੀਕ ਹੈ ਠੀਕ ਹੈ ਮੈਮ ਠੀਕ ਹੈ ਜੀ ਠੀਕ ਹੈ ਜੀ ਮੈਂ ਕੱਲ੍ਹ ਕੋਸ਼ਿਸ਼ ਕਰਦਾ ਮੈਂ ਮਿਲਾਂਗਾ ਆ ਕੇ ਅਤੇ ਆਪਾਂ ਟਾਈਮਲੀ ਮਿਲਦੇ ਹਾਂ ਅਤੇ ਸਾਰੀ ਡਿਸਕਸ਼ਨ ਉੱਥੇ ਹੀ ਕਰਦੇ ਜੀ ਠੀਕ ਹੈ ਮੈਮ ਥੈਂਕ ਯੂ ਜੀ ਓਕੇ ਓਕੇ ਜੀ ਓਕੇ ਜੀ ਓਕੇ ਜੀ